ਭਾਰਤ ਦੀ ਜਿਹੜੀ ਸਿੱਖਿਆ ਪ੍ਰਣਾਲੀ ਹੈ ਇਹ ਹੁਣ ਦਿਨੋਂ ਦਿਨ ਇਹਦੇ 'ਚ ਕਾਫ਼ੀ ਸੁਧਾਰ ਹੋ ਰਿਹਾ ਇਹ ਬਹੁਤ ਵਧੀਆ ਹੁੰਦੀ ਜਾ ਰਹੀ ਹੈ ਜਿਸ ਵਿੱਚ ਹੁਣ ਜੋ ਕਿ ਹਰ ਇੱਕ ਟੀਚਰ ਆਪਣੀ ਜ਼ਿੰਮੇਵਾਰੀ ਨਾਲ ਬੱਚਿਆਂ ਨੂੰ ਪੜ੍ਹਾ ਰਿਹਾ ਅਤੇ ਬਿਲਡਿੰਗਾਂ ਦੇ ਵਿੱਚ ਵੀ ਹੁਣ ਕੁਛ ਸੁਧਾਰ ਹੋ ਰਿਹਾ ਅਤੇ ਬੱਚਿਆਂ ਨੂੰ ਕੁਛ ਪੜ੍ਹਾਈ ਵੀ ਦੇ ਰਹੇ ਵਧੀਆ ਤਰੀਕੇ ਨਾਲ ਅਤੇ ਪੜ੍ਹਾਈ ਵੀ ਜਾ ਰਹੇ ਆ ਅਤੇ ਬੱਚਿਆਂ ਨੂੰ ਵਿੱਚ ਖਾਣਾ ਵੀ ਦੇ ਰਹੇ ਆ ਕਿ ਉਨ੍ਹਾਂ ਦਾ ਜ਼ਿਆਦਾ ਟਾਈਮ ਵੀ ਨਾ ਖ਼ਰਾਬ ਹੋਵੇ ਸਕੂਲ ਦੇ ਵਿੱਚ ਹੀ ਖਾਣਾ ਖਾ ਕੇ ਪੜ੍ਹ ਸਕਣ ਅਤੇ ਸਟੂਡੈਂਟ ਨਾਲ ਇਹ ਜਿਹੜੇ ਮਤਲਬ ਬੱਚਿਆਂ ਦੇ ਨਾਲ ਜਿਹੜੇ ਟੀਚਰ ਆ ਕਾਫ਼ੀ ਪਿਆਰ ਨਾਲ ਪ ਪੜ੍ਹਾਈ ਕਰਾ ਰਹੇ ਆ ਅਤੇ ਵੇਖੋ ਬਹੁਤ ਵਧੀਆ ਚੀਜ਼ ਹੁਣ ਅੱਗੇ ਨਾਲੋਂ ਕਾਫ਼ੀ ਜ਼ਿਆਦਾ ਫ਼ਰਕ ਪੈ ਗਿਆ ਅਤੇ ਬਾਕੀ ਜਿਹੜਾ ਪ੍ਰਾਈਵੇਟ ਸਕੂਲ ਆ ਪ੍ਰਾਈਵੇਟ ਸਕੂਲਾਂ ਦੇ ਇਹਦੇ 'ਚ ਥੋੜ੍ਹਾ ਜਿਹਾ ਹੋਣਾ ਚਾਹੀਦਾ ਕਿ ਜਿਵੇਂ ਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਟੂਰ ਵਗੈਰਾ ਕੱਢਦੇ ਆ ਅਤੇ ਉਨ੍ਹਾਂ ਵਾਂਗੂੰ ਥੋੜ੍ਹਾ ਜਿਹਾ ਬਿਲਡਿੰਗਾਂ ਉਨ੍ਹਾਂ ਦੀਆਂ ਜ਼ਿਆਦਾ ਕਲੀਨ ਹੁੰਦੀਆਂ ਸਾਫ਼ ਹੁੰਦੀਆਂ ਨੇ ਸੋ ਇਸੇ ਤਰੀਕੇ ਦੇ ਨਾਲ ਹੀ ਮਤਲਬ ਉਨ੍ਹਾਂ ਨਾਲ ਥੋੜ੍ਹਾ ਜਿਹਾ ਇਹਨਾਂ ਨੂੰ ਹੁਣ ਹੋਰ ਥੋੜ੍ਹਾ ਬਹੁਤ ਕਰਨਾ ਚਾਹੀਦਾ ਅਤੇ ਬਾਕੀ ਜੇ ਆਪਾਂ ਗੱਲ ਕਰੀਏ ਕਿ ਬਾਹਰਲੇ ਦੇਸ਼ਾਂ ਦੀ ਬਾਹਰਲੇ ਦੇਸ਼ਾਂ ਦੀ ਜਿਹੜੀ ਪੜ੍ਹਾਈ ਆ ਉਹ ਥੋੜ੍ਹਾ ਜਿਹਾ ਉਨ੍ਹਾਂ ਵਾਂਗੂ ਹੀ ਸਾਨੂੰ ਕਰਨਾ ਚਾਹੀਦਾ ਜਿਵੇਂ ਕਿ ਉਹ ਜ਼ਿਆਦਾ ਪ੍ਰੈਕਟੀਕਲ 'ਤੇ ਜ਼ਿਆਦਾ ਜ਼ੋਰ ਦਿੰਦੇ ਆ ਅਸਾਈਨਮੈਂਟ ਵਗੈਰਾ ਤਿਆਰ ਕਰਵਾਉਂਦੇ ਆ ਉਹ ਸਾਰਾ ਕੁਛ ਲਾਈਵ ਕਰਵਾਉਂਦੇ ਆ ਅਤੇ ਬੱਚਿਆਂ ਦੇ ਉੱਤੇ ਜ਼ਿਆਦਾ ਪੜ੍ਹਾਈ ਦਾ ਬੋਝ ਨਹੀਂ ਰੱਖਦੇ ਅਤੇ ਵਧੀਆ ਤਰੀਕੇ ਨਾਲ ਉਨ੍ਹਾਂ ਨੂੰ ਪੜ੍ਹਾਈ ਕਰਵਾਉਂਦੇ ਆ ਅਤੇ ਇਸੇ ਤਰ੍ਹਾਂ ਨਾਲ ਸਾਨੂੰ ਕੁਛ ਥੋੜ੍ਹਾ ਜਿਹਾ ਉਨ੍ਹਾਂ ਨੂੰ ਵੀ ਫੋਲੋ ਕਰਨਾ ਚਾਹੀਦਾ ਹਾਂਜੀ ਅਤੇ ਬਾਕੀ ਚਲੋ ਜੋ ਵੀ ਹੈ ਸਾਨੂੰ ਉਸ ਹਿਸਾਬ ਨਾਲ ਹੀ ਅੱਜ ਕੱਲ੍ਹ ਕੰਮ ਕਰਨਾ ਚਾਹੀਦਾ